ਹਾਂਜੀ ਇਹ ਗੱਲ ਕਾਫੀ ਹੱਦ ਤੱਕ ਸਹੀ ਹੈ ਕਿ ਪਿੰਡਾਂ ਵਿੱਚ ਡਾਂਸਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਉਰੇ ਵਧੀਆ ਕੋਚਿੰਗ ਸੈਂਟਰਾਂ ਦੀ ਕਮੀ ਹੈ ਜੇ ਕੋਚਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਦੇ ਸ਼ਹਿਰ ਜੋ ਉੱਥੋਂ ਨੇੜੇ ਪੈਂਦਾ ਉੱਥੇ ਜਾਣਾ ਪੈਂਦਾ ਅਤੇ ਕਈ ਬੱਚਿਆਂ ਕੋਲ ਉਵੇਂ ਜਾਣ ਲਈ ਸਾਧਨ ਨਹੀਂ ਹੁੰਦੇ ਹਨ ਕਿ ਉੱਥੇ ਪਹੁੰਚ ਸਕਣ ਬੜੇ ਬੱਚੇ ਤਾਂ ਜਾ ਸਕਦੇ ਨੇ ਛੋਟੇ ਬੱਚੇ ਤਾਂ ਬਾਈਕ ਵਗੈਰਾ ਨਹੀਂ ਚਲਾ ਸਕਦੇ ਤਾਂ ਬੱਚਿਆਂ ਨੂੰ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕਿ ਇਸ ਦੇ ਮੁਕਾਬਲੇ ਸ਼ਹਿਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੂਲਤਾਂ ਜ਼ਿਆਦਾ ਮਿਲਦੀਆਂ ਨੇ ਅਕੈਡਮੀਆਂ ਨੇੜੇ ਹੋਣ ਕਰਕੇ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਆਉਣਾ ਜਾਣਾ ਸੌਖਾ ਪਰ ਉਹੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਓਨੇ ਵਧੀਆ ਕੋਚਿੰਗ ਸੈਂਟਰ ਨਹੀਂ ਮਿਲਦੇ ਹੈਗੇ ਪਿੰਡਾਂ ਦੇ ਵਿੱਚ ਆਮ ਲੋਕ ਸਿੰਪਲ ਡਾਂਸ ਸਿਖਾ ਰਹੇ ਨੇ ਮਤਲਬ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜੇ ਡਾਂਸ ਦੀਆਂ ਫੋਰਮਸ ਨੇ ਅਲੱਗ ਅਲੱਗ ਉਹੋ ਜਿਹਾ ਨਹੀਂ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਉਸ ਲੈਵਲ ਦਾ ਜੋ ਕਿ ਉਹਨਾਂ ਨੂੰ ਸ਼ਹਿਰ ਵਿੱਚ ਮਿਲ ਸਕਦਾ ਸ਼ਹਿਰਾਂ ਵਿੱਚ ਵੀ ਵੱਡੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਵਧੀਆ ਸਿਖਾ ਰਹੇ ਨੇ ਜਿਵੇਂ ਸ਼ਾਮਕ ਡਾਵਰ ਹੋ ਗਿਆ ਫਰਾਂ ਖਾਨ ਹੋ ਗਏ ਇਹਨਾਂ ਦੇ ਕੋਚਿੰਗ ਸੈਂਟਰਾਂ 'ਚ ਸਿੱਖਿਆ ਬੱਚਾ ਅਤੇ ਇੱਕ ਆਮ ਡਾਂਸਰ ਦਾ ਸਿਖਾਇਆ ਬੱਚਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਕਿਉਂਕਿ ਅਧਿਆਪਕਾਂ 'ਤੇ ਵੀ ਇਹ ਗੱਲ ਬਹੁਤ ਜ਼ਿਆਦਾ ਸੁਨਿਸ਼ਚਿਤ ਹੁੰਦੀ ਹੈ ਕਿ ਵੀ ਬੱਚਾ ਕਿੰਨਾ ਕੁ ਸਿੱਖਦਾ ਜੇ ਵਧੀਆ ਅਧਿਆਪਕ ਦੀ ਉਹਨਾਂ ਨੂੰ ਸੇਧ ਮਿਲੇਗੀ ਤਾਂ ਬੱਚਾ ਉਸ ਅਕੋਰਡਿੰਗ ਹੀ ਵਧੀਆ ਸਿੱਖੇਗਾ ਤਾਂ ਇਸ ਲਈ ਕਹਿ ਸਕਦੇ ਹਾਂ ਕਿ ਪਿੰਡਾਂ ਵਿੱਚ ਡਾਂਸਰਾਂ ਨੂੰ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਰਕਾਰ ਨੂੰ ਚਾਹੀਦਾ ਕਿ ਹਰੇਕ ਤਰ੍ਹਾਂ ਦੀ ਸੈਂਟਰ ਹਰੇਕ ਤਰ੍ਹਾਂ ਦੀ ਸਿਖਲਾਈ ਚਾਹੇ ਉਹ ਡਾਂਸ ਨੂੰ ਵੀ ਉਹ ਲਾਈਟਲੀ ਨਾ ਲੈਣ ਅਤੇ ਡਾਂਸ ਨਾਲ ਰਿਲੇਟਡ ਵੀ ਇਹਨਾਂ ਨੂੰ ਕੋਚਿੰਗ ਸੈਂਟਰ ਪਿੰਡਾਂ 'ਚ ਖੋਲ੍ਹਣੇ ਚਾਹੀਦੇ ਹਨ ਧੰਨਵਾਦ